ਮੇਰਾ ਪਸੰਸੀਦਾ ਅਭਿਨੇਤਾ ਸਲਮਾਨ ਖਾਨ ਹੈ ਉਸਨੂੰ ਦੇਖ ਕੇ ਮੈਂ ਇੰਨਸਪਾਇਰ ਹੁੰਦਾ ਹਾਂ ਉਸਦੀ ਉਸਦੀ ਜਿਹੜੀ ਫਿਲਮਾਂ ਜਿੰਨੀਆਂ ਵੀ ਹੈ ਸਾਰੀਆਂ ਮੈਨੂੰ ਵਧੀਆ ਲੱਗਦੀਆਂ ਹਨ ਕਿਉਂਕਿ ਇੱਕ ਉਹ ਬੰਦਾ ਉਹ ਇੱਕਲੋਤਾ ਐਸਾ ਹੈ ਜਿਹੜਾ ਸ਼ੋਅ ਆਫ ਨਹੀਂ ਕਰਦਾ ਉਸਦੀ ਹਰੇਕ ਫਿਲਮ ਤੋਂ ਕੁਛ ਨਾ ਕੁਛ ਸਿੱਖਣ ਨੂੰ ਮਿਲਦਾ ਹੈ ਉਸਦੀ ਕਿਸੇ ਵੀ ਫਿਲਮ ਵਿੱਚ ਕੁਛ ਉਲ਼ਟ ਪਟਾਂਗ ਦੇਖਣ ਨੂੰ ਨਹੀਂ ਮਿਲਦਾ ਜਿਵੇਂ ਕਿ ਹੁਣ ਪਿੱਛੇ ਜਿਹੇ ਉਹਦੀ ਇੱਕ ਫਿਲਮ ਆਈ ਸੀ ਬਜਰੰਗੀ ਭਾਈਜਾਨ ਉਹ ਆਪ ਮੁਸਲਮਾਨ ਹਨ ਪਰ ਉਹਨਾਂ ਨੇ ਕਯਾ ਕੀਤਾ ਕਿ ਸਾਡੇ ਹਿੰਦੂ ਧਰਮ ਦੇ ਹਿੰਦੂ ਧਰਮ ਦੇ ਉਹਨੂੰ ਅਪਣਾਇਆ ਅਤੇ ਸਾਡੇ ਬਜਰੰਗ ਬਲੀ ਦਾ ਜੋ ਵੀ ਚੰਗੀ ਤਰ੍ਹਾਂ ਭਗਤ ਹੋਣ ਦਾ ਕਿਰਦਾਰ ਨਿਭਾਇਆ ਜੋ ਕਿ ਮੈਨੂੰ ਬਹੁਤ ਵਧੀਆ ਲੱਗਿਆ ਫਿਲਮ ਵੀ ਇੰਨੀ ਸੁਪਰ ਡੁਪਰ ਹਿੱਟ ਹੋਈ ਕਿ ਮੈਂ ਥਿਏਟਰ ਦੇ ਵਿੱਚ ਜਾ ਕੇ ਖ਼ੁਦ ਦੇਖ ਕੇ ਆਇਆ ਸੀ ਇੰਨਾ ਰਸ਼ ਸੀ ਕਿ ਟਿੱਕਟਾਂ ਤੱਕ ਨਹੀਂ ਮਿਲ ਰਹੀਆਂ ਸਨ ਅਤੇ ਗੱਲ ਕਰਾਂ ਉਨ੍ਹਾਂ ਦੇ ਉਹ ਵੀ ਮਤਲਬ ਕੋਈ ਜ਼ਿਆਦਾ ਐਟੀਟਿਉ਼ਡ ਨਹੀਂ ਉਸ ਬੰਦੇ ਵਿੱਚ ਜਿੰਨਾ ਵੀ ਕਰਦੇ ਹੈ ਵਧੀਆ ਕਰਦੇ ਹੈ ਹਰੇਕ ਦਾ ਸਾਥ ਦਿੰਦੇ ਹੈ